ਹਾਂਜੀ ਅਸੀਂ ਬਾਇਓਗੈਸ ਪਲਾਟ ਦੇਖਿਆ ਹੈ ਇਹ ਸਾਡੇ ਘਰ ਦੇ ਕੋਲ ਗਵਾਂਢੀ ਹਨ ਉਹਨਾਂ ਦੇ ਲੱਗਾ ਹੋਇਆ ਹੈ ਉਹਨਾਂ ਦੇ ਲੱਗਾ ਹੋਇਆ ਹੈ ਅਤੇ ਇਹ ਸਾਡੀ ਬਹੁਤ ਜ਼ਿਆਦਾ ਮਦਦ ਕਰ ਕਰਦਾ ਹੈ ਉਹਨਾਂ ਨੇ ਇਸ ਬਾਰੇ ਮੈਨੂੰ ਬਹੁਤ ਵਧੀਆ ਵਿਚਾਰ ਦਿੱਤੇ ਹਨ ਕਿ ਬਾਇਓਗੈਸ ਪਲਾਂਟ ਕਿਵੇਂ ਹੈ ਬਾਇਓਗੈਸ ਪਲਾਂਟ ਦਿਹਾਤੀ ਇਲਾਕੇ ਵਿੱਚ ਸਾਫ ਸੁਥਰੀ ਅਤੇ ਧੂੰਏ ਰਹਿਤ ਪ੍ਰ ਸਥਿਤੀ ਪ੍ਰਦਾਨ ਕਰਦਾ ਹੈ ਬਾਇਓਗੈਸ ਇੱਕ ਅਜਿਹਾ ਬਾਲਣ ਹੈ ਜੋ ਰਸੋਈ ਵਿੱਚ ਖਾਣਾ ਪਕਾਉਣ ਲਈ ਵਰਤਿਆ ਜਾਂਦਾ ਹੈ ਗੋਬਰ ਗੈਸ ਊਰਜਾ ਦਾ ਇੱਕ ਅਨੋਖਾ ਸਰੋਤ ਹੈ ਇੱਕ ਸਾਫ ਸੁਥਰਾ ਅਤੇ ਉੱਤਮ ਬਾਲਣ ਹੈ ਗੋਬਰ ਗੈਸ ਦਾ ਸੋਮਾ ਗਾਵਾਂ ਮੱਝਾਂ ਦਾ ਗੋਬਰ ਮਨੁੱਖੀ ਮਲ ਅਤੇ ਖੇਤਾਂ ਦੀ ਰਹਿੰਦ ਖੂੰਹਦ ਅਤੇ ਰਸੋਈ ਦੀਆਂ ਬੱਚੀਆਂ ਖੁਚੀਆਂ ਸਬਜ਼ੀਆਂ ਹਨ ਗੋਬਰ ਗੈਂਸ ਵਿੱਚ ਪਚਵੰਜਾ ਪ੍ਰਸੈਂਟ ਤੋਂ ਸੱਠ ਪ੍ਰਸੈਂਟ ਜਲਣਹੀਣ ਗੈਸ ਮਿਥੇਨ ਗੈਸ ਹੁੰਦੀ ਹੈ ਜਿਸ ਵਿੱਚ ਤੀਹ ਤੋਂ ਪੈਂਤੀ ਪ੍ਰਸੈਂਟ ਕਾਇਰ ਕਾਰਬਨ ਡਾਈਆਕਸਾਈਡ ਅਤੇ ਬਾਕੀ ਨਾਈਟ੍ਰੋਜਨ ਗੈਸ ਹਾਈਡ੍ਰੋਜਨ ਅਤੇ ਪਾਣੀ ਹੁੰਦਾ ਹੈ ਇਹ ਬਾਲਣ ਗਊਆਂ ਮੱਝਾਂ ਦੇ ਮਲ ਤੋਂ ਤਿਆਰ ਕੀਤਾ ਜਾਂਦਾ ਹੈ ਗੋਬਰ ਗੈਸ ਊਰਜਾ ਦਾ ਇੱਕ ਅਨੋਖਾ ਸਰੋਤ ਹੈ ਇੱਕ ਸਾਫ ਸੁਥਰਾ ਅਤੇ ਉੱਤਮ ਬਾਲਣ ਹੈ ਬਾਇਓਗੈਸ ਪਲਾਂਟ ਦੇਹਾਂਤੀ ਇਲਾਕੇ ਵਿੱਚ ਸਾਫ ਸੁਥਰੀ ਅਤੇ ਧੂੰਏ ਰਹਿਤ ਸਥਿਤੀ ਹੀ ਪ੍ਰਧਾਨ ਨਹੀਂ ਕਰਦੇ ਬਲਕਿ ਫਸਲ ਦੀ ਪੈਦਾਵਾਰ ਵਧਾਉਣ ਲਈ ਨਾਈਟ੍ਰੋਜਨ ਵਾਲੀ ਰਸਾਇਣ ਖਾਦ ਵੀ ਪੈਦਾ ਕਰਦੇ ਹਨ ਸਾਲ ਦੋ ਹਜ਼ਾਰ ਚਾਰ ਪੰਜ ਵਿੱਚ ਖੇਤੀਬਾੜੀ ਦਫਤਰ ਪੰਜਾਬ ਭਾਰਤ ਵੱਲੋਂ ਕੁੱਲ ਚਾਰ ਸੌ ਸਤੱਤਰ ਨਵੇਂ ਬਾਇਓਗੈਸ ਪਲਾਂਟ ਲਗਾਏ ਸਨ ਅਤੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ ਕੁੱਲ ਹਜ਼ਾਰ ਨਵੇਂ ਗੈਸ ਪਲਾਂਟ ਲਗਾਏ ਸਨ